ਹੈਲੋ ਵੀਰ ਜੀ ਤੁਸੀਂ ਉੱਭਰ ਤੋਂ ਬੋਲ ਰਹੇ ਹੋ ਮੈਂ ਤੁਹਾਡੀ ਪਿਛਲੀ ਸਵਾਰੀ ਬੋਲ ਰਿਹਾ ਜੋ ਪਹਿਲਾਂ ਤੁਸੀਂ ਉਤਾਰ ਕੇ ਗਏ ਹੋ ਮੈਨੂੰ ਮੇਰਾ ਨਾ ਜੀ ਪਰਸ ਤੁਹਾਡੀ ਗੱਡੀ 'ਚ ਰਹਿ ਗਿਆ ਸੀਗਾ ਅਤੇ ਉਹਦੇ ਵਿੱਚ ਮੇਰੇ ਸਾਰੇ ਕਾਗਜ਼ ਪੱਤਰ ਜਿਵੇਂ ਕਿ ਲਾਸੰਸ ਵਗੈਰਾ ਮੇਰਾ ਆਧਾਰ ਕਾਰਡ ਪੈਨ ਕਾਰਡ ਸਭ ਕੁਛ ਉਹਦੇ ਵਿੱਚ ਹੀ ਆ ਅਤੇ ਮੈਨੂੰ ਉਨ੍ਹਾਂ ਦੀ ਬਹੁਤ ਲੋੜ ਹੈ ਅਤੇ ਪਲੀਜ਼ ਜੇ ਤੁਸੀਂ ਆ ਕੇ ਮੇਰਾ ਵਾਪਸ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਜੇ ਤੁਸੀਂ ਅ ਅੱਧੇ ਰਾਸਤੇ ਵੀ ਜੇ ਦੂਰ ਦੂਰ ਚੱਲ ਗਏ ਹੋ ਤਾਂ ਮੈਂ ਤੁਹਾਡੇ ਅੱਧੇ ਰਾਸਤੇ ਆ ਜਾਂਦਾ ਅਤੇ ਪਲੀਜ਼ ਤੁਸੀਂ ਅੱਧੇ ਰਾਸਤੇ ਆ ਕੇ ਮੇਰਾ ਜੇ ਤੁਸੀਂ ਵਾਪਸ ਕਰ ਦਿਉ ਤਾਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਅਤੇ ਮੈਨੂੰ ਬਹੁਤ ਜ਼ਰੂਰੀ ਹੈ ਉਹ ਚੀਜ਼ ਅਤੇ ਮੈਂ ਉਹਦੇ ਤੋਂ ਬਿਨਾਂ ਮੈਨੂੰ ਮੇਰਾ ਕੰਮ ਨਹੀਂ ਚੱਲਣਾ ਤਾਂ ਪਲੀਜ਼ ਵੀਰ ਬਣਿਓ ਮੇਰਾ ਮੇਰਾ ਪਰਸ ਮੈਨੂੰ ਵਾਪਸ ਕੀਤਾ ਜਾਵੇ ਪਲੀਜ਼